ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਜਿੱਦਾਂ ਪੰਜਾਬ ਸੂਬਾ ਉਸ ਤੋਂ ਦੂਰ ਦੂਰ ਦੇ ਜਿਹੜੇ ਇਲਾਕੇ ਆ ਜਿਹੜੇ ਸ਼ਹਿਰ 'ਚ ਇਲਾਕੇ ਨਹੀਂ ਆਉਂਦੇ ਉੱਥੇ ਏ ਟੀ ਐਮ ਦੀ ਬਹੁਤ ਜ਼ਰੂਰਤ ਹੁੰਦੀ ਹੈ ਅਤੇ ਏ ਟੀ ਐਮ ਤੋਂ ਜ਼ਿਆਦਾ ਏ ਟੀ ਐਮ ਤਾਂ ਬਣੇ ਦੀ ਨਹੀਂ ਹੁੰਦੇ ਵੈਸੇ ਜਿਹੜੇ ਸ਼ਹਿਰ ਤੋਂ ਦੂਰ ਦੂਰ ਦੇ ਇਲਾਕੇ ਹੁੰਦੇ ਕਿਤੇ ਇੱਕ ਏ ਟੀ ਐਮ ਹੁੰਦਾ ਪਰ ਉਹਦਾ ਵੀ ਜਿਹੜਾ ਰੇਟਿੰਗ ਸਕੇਲ ਆ ਉਹ ਜ਼ਿਆਦਾ ਵਧੀਆ ਨਹੀਂ ਹੁੰਦਾ ਕਈ ਵਾਰੀ ਉਹ 'ਚ ਕੈਸ਼ ਹੀ ਨਹੀਂ ਹੁੰਦਾ ਕਈ ਵਾਰੀ ਏ ਟੀ ਐਮ 'ਚ ਪੈਸੇ ਪਾਉਣ ਵਾਲੇ ਨਹੀਂ ਆਉਂਦੇ ਇਸ ਕਰਕੇ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਗ੍ਰਾਮੀਣ ਲੋਕਾਂ ਨੂੰ ਕਿਉਂਕਿ ਹਰ ਕੋਈ ਪੜ੍ਹਿਆ ਲਿਖਿਆ ਨਹੀਂ ਹੁੰਦਾ ਕਈ ਵਾਰੀ ਉੱਥੇ ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਆ ਉਹਦੀ ਫੈਸਿਲਿਟੀ ਨਹੀਂ ਹੁੰਦੀ ਆ ਸਾਰਿਆਂ ਲਈ ਬਹੁਤ ਸਮੱਸਿਆ ਹੁੰਦੀ ਹੈ ਕਿ ਉਹ ਕਿਵੇਂ ਏ ਟੀ ਐਮ ਚਲਾਏ ਕਿਵੇਂ ਨਹੀਂ ਚਲਾਏ ਔਰ ਸਾਡੀ ਸਰਕਾਰ ਨੂੰ ਚਾਹੀਦਾ ਕਿ ਉੱਥੇ ਇੱਕ ਇੱਕ ਸਿਕਿਉਰਿਟੀ ਗਾਰਡ ਬੰਦਾ ਖੜ੍ਹਾ ਕਰ ਦੇ ਔਰ ਵਧੀਆ ਤੋਂ ਵਧੀਆ ਸੇਵਾ ਦੇਵੇ ਹੈ ਨਾ ਸਾਰਿਆਂ ਨੂੰ ਏ ਟੀ ਐਮ ਦੇ ਬਾਰੇ ਜਾਗਰੂਕ ਕਰਨਾ ਚਾਹੀਦਾ ਕਿ ਏ ਟੀ ਐਮ ਕਿਵੇਂ ਕਿਵੇਂ ਚਲਾ ਸਕਦੇ ਹਾਂ ਆਪਾਂ ਇਹ ਮੇਨ ਗੱਲ ਹੈ ਔਰ ਜਿਹੜੇ ਮੇਰੇ ਇਲਾਕੇ 'ਚ ਏ ਟੀ ਐਮ ਹੈ ਮੈਂ ਉਹਨੂੰ ਰੇਟਿੰਗ ਦੇਵਾਂਗੀ ਪੰਜ ਵਿੱਚੋਂ ਮੈਂ ਉਹਨੂੰ ਤਿੰਨ ਦੇਣਾ ਚਾਹਾਂਗੀ ਰੇਟਿੰਗ ਕਿਉਂਕਿ ਉਹਦੀ ਸਰਵਿਸ ਇੰਨੀ ਵਧੀਆ ਨਹੀਂ ਹੈ ਕਈ ਵਾਰੀ ਮੈਂ ਜਾਂਦੀ ਹਾਂ ਕਈ ਵਾਰੀ ਇਨਸਾਨ ਦੀ ਲੋੜ ਹੁੰਦੀ ਹੈ ਪੈਸੇ ਨਹੀਂ ਹੁੰਦੇ ਫਿਰ ਬੰਦਾ ਉੱਥੇ ਫਸ ਜਾਂਦੇ ਫਿਰ ਬੰਦਾ ਕੀ ਕਰ ਸਕਦਾ ਉੱਥੇ ਕੁਛ ਨਹੀਂ ਕਰ ਸਕਦਾ ਸਾਡੀ ਸਰਕਾਰ ਨੂੰ ਚਾਹੀਦਾ ਕਿ ਫਾਲਤੂ ਦੇ ਕੰਮਾਂ ਛੱਡ ਕੇ ਥੋੜ੍ਹਾ ਇਸ ਆਮ ਆਦਮੀ ਦੀ ਜਿਹੜੀ ਜ਼ਰੂਰਤ ਹੈ ਉਸ ਵੱਲ ਵੀ ਧਿਆਨ ਦੇਵੇ